ਮੈਨੂੰ ਘੁੰਮਣਾ ਇਸ ਕਰਕੇ ਪਸੰਦ ਆ ਕਿ ਨਵੀਆਂ ਨਵੀਆਂ ਜਗ੍ਹਾ ਦੇਖਣ ਨੂੰ ਮਿਲਦੀਆਂ ਹਨ ਅਤੇ ਜਦ ਅਸੀਂ ਕਿਸੇ ਵੀ ਨਵੀਂ ਜਗ੍ਹਾ ਦੇ ਉੱਤੇ ਜਾਂਦੇ ਹਾਂ ਤਾਂ ਉਹਨਾਂ ਦੇ ਸਮਾਜ ਬਾਰੇ ਸਾਨੂੰ ਪਤਾ ਲੱਗਦਾ ਹੈ ਕਿ ਲੋਕਾਂ ਦਾ ਉੱਥੇ ਦੇ ਜਿਹੜੀ ਨਵੀਂ ਜਗ੍ਹਾ 'ਤੇ ਜਾਂਦੇ ਅਤੇ ਜਾਂਦੇ ਹਾਂ ਉੱਥੇ ਦੇ ਲੋਕਾਂ ਦਾ ਰਹਿਣ ਸਹਿਣ ਕਿਵੇਂ ਦਾ ਹੈ ਅਤੇ ਉਹ ਕਿਵੇਂ ਲੋਕਾਂ ਵਿੱਚ ਵਿਚਰਦੇ ਹਨ ਅਤੇ ਮੈਨੂੰ ਇੱਕ ਨਵੀਂ ਜਗ੍ਹਾ ਦੇ ਉੱਤੇ ਇਸ ਕਰਕੇ ਵੀ ਘੁੰਮਣਾ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਨਵੀਆਂ ਨਵੀਆਂ ਜਿਹੜੀ ਵੀ ਰੱਬ ਦੁਆਰਾ ਬਣਾਈਆਂ ਹੋਈਆਂ ਕੁਦਰਤੀ ਚੀਜ਼ਾਂ ਨੇ ਉਹਨਾਂ ਨੂੰ ਦੇਖਣਾ ਬਹੁਤ ਵਧੀਆ ਲੱਗਦਾ ਹੈ ਕਿ ਜਿਹੜੀ ਇੱਕ ਮਨ ਨੂੰ ਸ਼ਾਂਤੀ ਦਿੰਦੇ ਹੈ ਜਿਵੇਂ ਕੋਈ ਵੀ ਨੇ ਨੇਚਰ ਵਾਲੀਆਂ ਚੀਜ਼ਾਂ ਹੋ ਗਈਆਂ ਨੇ ਵਾਟਰ ਫਾਲ ਹੋ ਗਏ ਜੰਗਲ ਹੋ ਗਏ ਨੇ ਇਹ ਦਿਲ ਨੂੰ ਮਨ ਨੂੰ ਇੱਕ ਸਕੂਨ ਦਿੰਦੇ ਹਨ